ਸ਼ਹਿਰਾਂ ਵਿੱਚ ਹਰ ਜਸ਼ਨ ਪਾਰਟੀ ਤਾਂ ਕਲੱਬਾਂ ਵਿੱਚ ਮਨਾਇਆ ਜਾਂਦਾ ਹੈ ਪਰ ਪੰਜਾਬ ਦੇ ਕੁਝ ਪਿੰਡ ਅਜੇ ਵੀ ਇਹੋ ਜਿਹੇ ਹਨ ਜੋ ਇਹਨਾਂ ਸਭ ਤੋਂ ਬਹੁਤ ਪਰੇ ਹਨ ਜਿਨ੍ਹਾਂ ਵਿੱਚੋਂ ਇੱਕ ਮੇਰਾ ਪਿੰਡ ਵੀ ਹੈ ਮੇਰੇ ਪਿੰਡ ਵਿੱਚ ਸ਼ਹਿਰਾਂ ਦੇ ਜਸ਼ਨ ਨੂੰ ਸੰਤੁਲਿਤ ਕਰਨ ਲਈ ਪਿੰਡ ਵਿੱਚ ਅਖਾੜਾ ਲਾਇਆ ਜਾਂਦਾ ਹੈ ਜਿੱਥੇ ਲੋਕਾਂ ਦੇ ਨੱਚਣ ਅਤੇ ਗਾਉਣ ਦਾ ਸ਼ੌਂਕ ਪੂਰਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਵਿਆਹਾਂ ਵਿੱਚ ਬੋਲੀਆਂ ਅਤੇ ਘੋੜੀਆਂ ਸੁਹਾਗ ਮਨੋਰੰਜਨ ਦੇ ਆਧੁਨਿਕ ਰੂਪਾਂ ਨੂੰ ਸੰਤੁਲਿਤ ਕਰਦੇ ਹਨ ਜੰਝ ਵੇਲੇ ਢੋਲੀ ਦੁਆਰਾ ਵਜਾਇਆ ਜਾਂਦਾ ਢੋਲ ਵੀ ਕਿਸੇ ਕਲੱਬ ਦੇ ਸਾਊਂਡ ਸਿਸਟਮ ਤੋਂ ਘੱਟ ਨਹੀਂ ਹੁੰਦਾ ਕੁਝ ਇਸ ਤਰ੍ਹਾਂ ਹੀ ਪਿੰਡਾਂ ਦੇ ਲੋਕ ਆਪਣੀ ਰਵਾਇਤੀ ਕਦਰਾਂ ਕੀਮਤਾਂ ਨੂੰ ਮਨੋਰੰਜਨ ਦੇ ਆਧੁਨਿਕ ਰੂਪਾਂ ਵਜੋਂ ਸੰਤੁਲਿਤ ਕਰਦੇ ਆ ਜੇਕਰ ਅਸੀਂ ਆਪਣੀ ਗੱਲ ਕਰੀਏ ਤਾਂ ਅਸੀਂ ਅੱਜ ਤੱਕ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕੀਤਾ ਅਸੀਂ ਆਪਣਾ ਮਨੋਰੰਜਨ ਪੁਰਾਣੇ ਰੀਤੀ ਰਿਵਾਜ਼ਾਂ ਅਨੁਸਾਰ ਹੀ ਕਰਦੇ ਹਾਂ ਅਜੋਕੇ ਮਨੋਰੰਜਕ ਸਾਧਨਾ ਦੀ ਵਰਤੋਂ ਨਹੀਂ ਕਰਦੇ